ਸਾਡਾ ਜਾਨਵਰਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ ਅਸੀਂ ਆਪਦੇ ਘਰ ਜੋ ਪਸ਼ੂ ਜਾਨਵਰ ਰੱਖਦੇ ਐਂ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸੰਭਾਲਦੇ ਹਾਂ ਉਹ ਵੀ ਸਾਡਾ ਓਨਾ ਹੀ ਕਰਦੇ ਹੈ ਹੁਣ ਜਿਵੇਂ ਅਸੀਂ ਘਰੇ ਗਾਂ ਰੱਖੀ ਹੋਈ ਹੈ ਅਸੀਂ ਸਾਡਾ ਛੋਟਾ ਜਿਹਾ ਬੱਚਾ ਹੈ ਘਰੇ ਉਹ ਬਿਮਾਰ ਹੁੰਦਾ ਸੀ ਸਾਨੂੰ ਡਾਕਟਰ ਨੇ ਕਿਹਾ ਵੀ ਇਹਨੂੰ ਦੁੱਧ ਜੋ ਡੇਅਰੀ ਦਾ ਹੈ ਉਹਨੂੰ ਕੁਛ ਨਹੀਂ ਦੇਣਾ ਹੈਗਾ ਇਸ ਕਰਕੇ ਅਸੀਂ ਹੁਣ ਘਰੇ ਗਾਂ ਰੱਖੀ ਹੈ ਅਸੀਂ ਹੁਣ ਬਿਨਾਂ ਦਵਾਈ ਤੋਂ ਵੀ ਸਾਡਾ ਬੱਚਾ ਠੀਕ ਹੈ ਨਹੀਂ ਤਾਂ ਅਸੀਂ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਸੀਗੇ ਇਸ ਕਰਕੇ ਅਸੀਂ ਉਹਨੂੰ ਵੀ ਘਰੇ ਰੱਖਿਆ ਉਹਦੀ ਸਾਂਭ ਸੰਭਾਲ ਕਰਦੇ ਹਾਂ ਉਹਨੂੰ ਦੋ ਟਾਈਮ ਨਵਾਉਂਨੇ ਹੈ ਪ ਪੱਖੇ ਲਾ ਕੇ ਰੱਖਦੇ ਹਾਂ ਵੀ ਆਪਦੇ ਬੱਚਿਆਂ ਵਾਂਗੂੰ ਹੀ ਜਿਵੇਂ ਸੰਭਾਲ ਕੇ ਰੱਖਿਆ ਹੋਇਆ ਜੇ ਅਸੀਂ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਦੇ ਹਾਂ ਉਹ ਸਾਨੂੰ ਵਧੀਆ ਦੁੱਧ ਦਿੰਦੀ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਘਰੇ ਪਾਲਿਆ ਹੋਇਆ ਅਸੀਂ ਇਹਦਾ ਦੁੱਧ ਵਰਤਦੇ ਹਾਂ ਬੱਚਿਆਂ ਨੂੰ ਦਿੰਦੇ ਐਂ ਮੱਖਣ ਪਨੀਰ ਜੋ ਵੀ ਕੋਈ ਚੀਜ਼ ਦੀ ਲੋੜ ਹੁੰਦੀ ਹੈ ਅਸੀਂ ਆਪਦੇ ਘਰੇ ਬਣਾ ਕੇ ਦਿੰਦੇ ਐਂ ਇਸ ਕਰਕੇ ਵੀ ਸਾਨੂੰ ਆਪਦੇ ਜਾਨਵਰਾਂ ਨਾਲ ਵਧੀਆ ਰਿਸ਼ਤਾ ਰੱਖਣਾ ਚਾਹੀਦਾ ਵਧੀਆ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੇ ਆਪਾਂ ਇਹਨਾਂ ਦੀ ਸੰਭਾਲ ਕਰਾਂਗੇ ਤਾਂ ਇਹ ਸਾਨੂੰ ਵੀ ਓਨਾ ਹੀ ਯੋਗਦਾਨ ਦਿੰਦੇ ਹੈ ਇਸੇ ਕਰਕੇ ਵੀ ਜੇ ਹੁਣ ਅਸੀਂ ਦੁੱਧ ਡੇਅਰੀ ਤੋਂ ਲਿਆਉਂਦੇ ਹਾਂ ਉਹਦੇ ਵਿੱਚ ਪਤਾ ਨਹੀਂ ਉਹ ਕੀ ਕੁਛ ਪਾਉਂਦੇ ਹੈ ਜਿਵੇਂ ਰਾਤ ਨੂੰ ਦੁੱਧ ਦੇ ਵਿੱਚ ਕੁਛ ਲਾ ਕੇ ਰੱਖਦੇ ਆ ਕੈਮੀਕਲ ਉਹ ਸਾਡੀ ਸਿਹਤ ਨਾਲ ਖਿਲਵਾੜ ਹੈ ਜਾਂ ਅਸੀਂ ਵੀ ਕੋਈ ਹੋਰ ਦੁੱਧ ਦੇ ਪ੍ਰੋਡਕਟ ਬਣੇ ਲੈਂਦੇ ਐਂ ਜਿਵੇਂ ਖੀਰ ਬਣੀ ਹੁੰਦੀ ਹੈ ਵੇਰਕਾ ਵਾਲਿਆਂ ਦੀ ਜਾਂ ਹੋਰ ਪਨੀਰ ਵਗੈਰਾ ਕਿੰਨੇ ਕਿੰਨੇ ਦਿਨ ਰਹਿੰਦੇ ਹੈ ਹੁਣ ਦੇਖੋ ਆਪਾਂ ਘਰੇ ਰੱਖੀਏ ਆਪਣਾ ਦੂਜੇ ਦਿਨ ਤੀਜੇ ਦਿਨ ਨੂੰ ਚੀਜ਼ ਖਰਾਬ ਹੋ ਜਾਂਦੀ ਹੈ ਉਹ ਕੀ ਪਤਾ ਕੀ ਕੈਮੀਕਲ ਲਾਉਂਦੇ ਹੈ ਜਿਹੜਾ ਵੀ ਕਿੰਨੇ ਕਿੰਨੇ ਦਿਨ ਪਿਆ ਰਹਿੰਦਾ ਉਹ ਕਿਹੜਾ ਕੋਈ ਆਪਾਂ ਨੂੰ ਟਾਈਮ ਸਿਰ ਬਣਾ ਕੇ ਦਿੰਦੇ ਹੈ ਪਹਿਲਾਂ ਦੀ ਬਣੀ ਚੀਜ਼ ਹੀ ਹੁੰਦੀ ਹੈ ਉਹ ਖਾ ਖਾ ਕੇ ਆਪਣੇ ਦੂਜਾ ਸਿਹਤ ਬਿਲਕੁਲ ਖਰਾਬ ਹੋ ਜਾਂਦੀ ਹੈ ਇਸ ਕਰਕੇ ਅਸੀਂ ਆਪਦੇ ਘਰੇ ਗਾਂ ਰੱਖ ਕੇ ਉਸੇ ਦੇ ਦੁੱਧ ਦਾ ਸਾਰਾ ਕਰਦੇ ਹਾਂ ਸਾਡਾ ਬੱਚਾ ਵੀ ਠੀਕ ਹੈ ਅਤੇ ਦੁੱਧ ਵੀ ਵਧੀਆ ਸਾਡੀ ਸਾਰਿਆਂ ਦੀ ਸਿਹਤ ਠੀਕ ਹੈ ਇਸ ਕਰਕੇ ਅਸੀਂ ਘਰੇ ਗਾਂ ਰੱਖੀ ਹੋਈ ਹੈ